ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਜੋਗੇ ਤੋਂ ਬੋਲ ਰਹੇ ਹਾਂ ਹਾਂਜੀ ਹਾਂਜੀ ਹਾਂਜੀ ਆਪਣਾ ਬੂਟਾਂ ਦਾ ਕੰਮ ਆ ਜੀ ਬਹੁਤ ਵਧੀਆ ਬੂਟ ਆ ਹਾਂ ਅਲੱਗ ਅਲੱਗ ਫੈਸ਼ਨ ਆ ਨੰਬਰ ਆ ਸਾਈਜ ਅਲੱਗ ਅਲੱਗ ਮਿਲਦੇ ਨੇ ਅੱਛਾ ਠੀਕ ਹੈ ਠੀਕ ਆ ਬਹੁਤ ਅੱਛੇ ਬੇਟਾ ਬਹੁਤ ਅੱਛੇ ਹਾਂਜੀ ਹਾਂਜੀ ਬਹੁਤ ਵਧੀਆ ਸਸਤੇ ਰੇਟ ਆ ਬਾਕੀਆਂ ਨਾਲੋਂ ਜਿੰਨੇ ਵੀ ਤੁਸੀਂ ਦੁਕਾਨਾਂ 'ਤੇ ਜਾਉਂਗੇ ਸਭ ਨਾਲੋਂ ਸਸਤਾ ਕੁਆਲਿਟੀ ਇੱਕ ਨੰਬਰ ਮਿਲੇਗਾ ਆਪਣੇ ਕੋਲੋਂ ਬੂਟ ਕੁਆਲਟੀ ਇੱਕ ਨੰਬਰ ਹੈ ਇੱਕ ਨੰਬਰ ਆ ਆਪਣੇ ਆਪ ਦੀ ਕਿ ਬ੍ਰਾਂਡ ਆ ਪੂਰਾ ਨੰਬਰ ਵੰਨ ਹੈ ਨੰਬਰ ਵੰਨ ਹੈ ਸੂਜ਼ ਮਿਲਣਗੇ ਇੱਕ ਵਾਰ ਤੁਸੀਂ ਆਪਣੀ ਦੁਕਾਨ 'ਤੇ ਆਓ ਅਤੇ ਬੂਟ ਖਰੀਦੋ ਅਤੇ ਚੈਕ ਕਰੋ ਵਾਕਈ ਤੁਸੀਂ ਕਹੋਗੇ ਵੀ ਹਾਂ ਬੂਟ ਆਪਣੇ ਇਹੀ ਵਰਤਣੇ ਆ ਆਪਾਂ ਅੱਛਾ ਅੱਛਾ ਬਲੈਕ ਉਹ ਜਿਹੜੇ ਵਾਈਟ ਦੇ ਨਾਲ ਸੀਗੇ ਐਡ ਦੇ ਵਿੱਚ ਅੱਛਾ ਅੱਛਾ ਉਹਦਾ ਸੋਲ੍ਹਾਂ ਸੌ ਰੁਪਏ ਪ੍ਰਾਈਜ ਆ ਹਾਂ ਹਾਂ ਨਹੀਂ ਨਹੀਂ ਆਪਣਾ ਵਾਕਿਆ ਦੂਜੀਆਂ ਦੁਕਾਨਾਂ ਨੂੰ ਤੁਸੀਂ ਦੇਖਿਓ ਵਰਤੇ ਹੋਊਗੇ ਤੁਸੀਂ ਪਹਿਲਾਂ ਵੀ ਤਾਂ ਆਪਣਾ ਇੱਕ ਵਾਰ ਤੁਸੀਂ ਨਾ ਬੂਟ ਵਰਤ ਕੇ ਦੇਖੋ ਹਾਂ ਹਾਂ ਤੁਸੀਂ ਹੱਕੇ ਬੱਕੇ ਰਹਿ ਜਾਉਂਗੇ ਇੱਕ ਵਾਰ ਤੁਸੀਂ ਆਪਣੇ ਦੁਕਾਨ 'ਤੇ ਆਇਓ ਅਤੇ ਖ਼ਰੀਦਿਓ ਚੀਜ਼ ਕੋਈ ਗੱਲ ਨਹੀਂ ਆਪਾਂ ਘੱਟ ਵੱਧ ਕਰ ਲਵਾਂਗੇ ਅ ਹਾਂ ਹਾਂ ਜ਼ਰੂਰ ਜ਼ਰੂਰ ਜ਼ਰੂਰ ਗਰੰਟੀ ਆਪਾਂ ਦਿੰਦੇ ਆ ਜੀ ਗਰੰਟੀ ਲਾਈਫ ਟਾਈਮ ਦੀ ਗਰੰਟੀ ਆ ਲੇ ਲੇਡੀਜ ਵੀ ਮਿਲ ਜਾਂਦੇ ਜੀ ਆਪਣੇ ਕੋਲ ਲੇਡੀ ਵੀ ਮਿਲ ਜਾਂਦੇ ਆ ਬੱਚਿਆਂ ਵਾਲੇ ਲੇਡੀਜ ਹਾਂਜੀ ਹਾਂਜੀ ਹਾਂਜੀ ਆਪਣੇ ਕੋਲ ਵਧੀਆ ਵਧੀਆ ਕੰਪਨੀਆਂ ਸਾਰੀਆਂ ਹੁੰਦੀਆਂ ਨੇ ਬੱਚਿਆਂ ਦੇ ਵੀ ਮਿਲ ਜਾਂਦੇ ਆ ਲੇਡੀਜ ਵੀ ਮਿਲ ਜਾਂਦੇ ਆ ਜੈਂਟਸ ਵੀ ਨੇ ਆਪਣੇ ਕੋਲ ਹਾਂਜੀ ਹਾਂਜੀ ਆਪ ਜੀ ਤੁਸੀਂ ਗੂਗਲ ਪੇ ਕਰ ਦਿਓ ਬਸ ਪੇਮੈਂਟ ਆਪਾਂ ਪੰਜ ਚਾਰ ਦਿਨਾਂ ਤੱਕ ਤੁਸੀਂ ਮੈਨੂੰ ਆਧਾਰ ਕਾਰਡ ਭੇਜ ਦਿਓ ਆਹੀ ਨੰਬਰ 'ਤੇ ਆਪਣੇ 'ਤੇ ਆਧਾਰ ਕਾਰਡ ਭੇਜ ਦਿਓ ਵਟਸਅੱਪ ਕਰ ਦਿਓ ਅਤੇ ਆਪਾਂ ਗੂਗਲ ਪੇ ਕਰ ਦਿਓ ਪੈਸੇ ਅਤੇ ਤੁਹਾਡੇ ਘਰ ਆ ਜਾਣਗੇ ਕੋਈ ਚੱਕਰ ਹੀ ਨਹੀਂ ਹਾਂ ਹਾਂ ਆਪਾਂ ਹੋਮ ਡਿਲੀਵਰੀ ਵੀ ਕਰਦੇ ਹਾਂ ਹਾਂ ਹਾਂ ਆਹੀ ਨੰਬਰ 'ਤੇ ਗੂਗਲ ਪੇ ਕਰ ਦਿਓ ਨਹੀਂ ਨਹੀਂ ਨਹੀਂ ਨਹੀਂ ਨਹੀਂ ਨਹੀਂ ਨਹੀਂ ਆਪਾਂ ਉਹ ਆਪਣੀ ਗਰੰਟੀ ਆ ਦੇਖੋ ਜੇਕਰ ਕੋਈ ਪੀਸ ਡਿਫੈਕਟ ਹੁੰਦਾ ਤਾਂ ਤੁਸੀਂ ਕਦੋਂ ਮਰਜ਼ੀ ਆ ਕੇ ਆਪਣੇ ਕੋਲੋਂ ਬਦਲ ਕੇ ਲਿਜਾ ਸਕਦੇ ਹੋ ਆਪਣੀ ਫੁੱਲ ਗਰੰਟੀ ਆ ਹਾਂ ਹਾਂ ਬਸ ਆਹੀ ਨੰਬਰ 'ਤੇ ਬਸ ਤੁਸੀਂ ਗੂਗਲ ਪੇ ਕਰ ਦਿਓ ਅੱਠ ਨੰਬਰ ਆਉਂਦੇ ਆ ਬਸ ਠੀਕ ਹੈ ਠੀਕ ਹੈ ਕੋਈ ਗੱਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਆਪਾਂ ਮੌਕੇ 'ਤੇ ਕਰ ਲਵਾਂਗੇ ਤੁਸੀਂ ਸਲੈਕਟ ਕਰੋ ਆਪਣੇ ਸੂਜ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਾਕੀਆਂ ਨਾਲੋਂ ਤੁਸੀਂ ਹੋਰ ਸੌ ਰੁਪਏ ਘੱਟ ਦੇ ਦਿਓ ਕੋਈ ਗੱਲ ਨਹੀਂ ਠੀਕ ਹੈ ਠੀਕ